ਹਾਂਜੀ ਡਾਂਸ ਅਤੇ ਰੀਲਾਂ ਦੇਖਣਾ ਮੈਨੂੰ ਬਹੁਤ ਪਸੰਦ ਹੈ ਅਤੇ ਮੈਂ ਸ਼ੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ ਅਤੇ ਫੇਸਬੁਕ ਸਾਰਾ ਸਾਰਿਆਂ 'ਤੇ ਦੇਖਦੀ ਹਾਂ ਜਿਹਦੇ ਵਿੱਚ ਮੈਨੂੰ ਕਾਫੀ ਸਾਰੇ ਹੈਗੇ ਆ ਮੌਡਲ ਜਿਹਦੇ ਵਿੱਚ ਰੀਲਾਂ ਅਤੇ ਉਹਨਾਂ ਦੇ ਮੈਨੂੰ ਬਹੁਤ ਜ਼ਿਆਦਾ ਪਸੰਦ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਆ ਸ਼ ਸ਼ੋਰਟਸ ਅਤੇ ਉਹਨਾਂ ਦੀਆਂ ਜਿਹੜੀਆਂ ਸ਼ੋਰਟਕੱਟ ਵੀਡੀਓਜ਼ ਹੁੰਦੀਆਂ ਨੇ ਉਹ ਮੈਨੂੰ ਬਹੁਤ ਪਸੰਦ ਨੇ ਸ਼ੋਸ਼ਲ ਮੀਡੀਆ 'ਤੇ ਇੰਸਟਾਗਰਾਮ 'ਤੇ ਮੈਂ ਬਹੁਤ ਜ਼ਿਆਦਾ ਮਤਲਬ ਦੇਖਦੀ ਹਾਂ ਅਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਇਹ ਇੰਸਟਾਗਰਾਮ 'ਤੇ ਜਿਹੜੀਆਂ ਹੈਗੀਆਂ ਗੁਰਨਾਮ ਭੁੱਲਰ ਦੀਆਂ ਜਿਹੜੀਆਂ ਸਿੰਗਰ ਹੈਗੇ ਅਤੇ ਉਹਨਾਂ ਦੇ ਨਾਲ ਜਿਹੜੇ ਮੈਮ ਨੇ ਉਹਨਾਂ ਦੇ ਜਿਹੜੇ ਵੀਡੀਓਜ਼ ਨੇ ਹੈਗੀਆਂ ਨੇ ਉਹ ਸੌਂਗ ਸਾਰੇ ਸ਼ੋਰਟਸ ਜਿਹੜੇ ਹੁੰਦੇ ਆ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਅਤੇ ਮੈਂ ਇਸਟਾਗਰਾਮ 'ਤੇ ਵੀਡੀਓ ਬਣਾਉਣਾ ਅਤੇ ਲਾਈਕ ਕਰਨਾ ਸ਼ੇਅਰ ਕਰਨਾ ਮੈਨੂੰ ਸਾਰਾ ਕੁਛ ਬਹੁਤ ਪਸੰਦ ਹੈ ਅਤੇ ਮੈਂ ਇਹਨਾਂ ਦੇ ਸ਼ੋਸ਼ਲ ਮੀਡੀਆ ਨੂੰ ਬਹੁਤ ਪਸੰਦ ਕਰਦੀ ਹਾਂ ਜਿਹਦੇ ਵਿੱਚ ਟਿਕਟੋਕ ਫੇਸਬੁੱਕ ਇੰਸਟਾਗ੍ਰਾਮ ਉਹਨਾਂ ਸਾਰਿਆਂ ਨੂੰ ਮੈਂ ਯੂਜ਼ ਕਰਦੀ ਹਾਂ ਅਤੇ ਉਹਨਾਂ ਨੂੰ ਮੈਂ ਦੇਖਦੀ ਹੈਗੀ ਹਾਂ ਅਤੇ ਉਹਦੇ ਬਹੁਤ ਜ਼ਿਆਦਾ ਮੈਨੂੰ ਪਸੰਦ ਹੈਗਾ ਅਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਮੈਂ ਬਹੁਤ ਜ਼ਿਆਦਾ ਮਤਲਬ ਜਿਹੜੇ ਹੈਗੇ ਆ ਪਸੰਦ ਕਰਦੀ ਹੈਗੀ ਹਾਂ ਅਤੇ ਨੇਹਾ ਕੱਕੜ ਉਹ ਬਹੁਤ ਵਧੀਆ ਸਿੰਗਰ ਵੀ ਨੇ ਅਤੇ ਬਹੁਤ ਅੱਛੇ ਡਾਂਸ ਵੀ ਨੇ ਅਤੇ ਬਹੁਤ ਅੱਛੇ ਮਤਲਬ ਕਿ ਉਹ ਪਰਸਨ ਵੀ ਬਹੁਤ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਵਧੀਆ ਨੇ ਉਹਨਾਂ ਦਾ ਉਹਨਾਂ ਦਾ ਮੈਂ ਗੱਲ ਕਰਨ ਦਾ ਤਰੀਕਾ ਸ਼ੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਧੀਆ ਹੈ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਆਪਣਾਪਨ ਜ਼ਿਆਦਾ ਮਹਿਸੂਸ ਹੁੰਦਾ ਹੈ ਅਤੇ ਉਹ ਹਰ ਇੱਕ ਨਾਲ ਹਰ ਇੱਕ ਗੱਲ ਬਹੁਤ ਜ਼ਿਆਦਾ ਮਤਲਬ ਕਿ ਖੁੱਲ੍ਹ ਕੇ ਕਰਦੇ ਹਨ ਉਹਨਾਂ ਨੂੰ ਸਾਰੇ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਅਤੇ ਮੈਂ ਵੀ ਉਹਨਾਂ ਦੀ ਬਹੁਤ ਜ਼ਿਆਦਾ ਵੱਡੀ ਫੈ ਫੈਨ ਹਾਂ ਅਤੇ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ